ਪੰਜਾਬੀ ਭਾਸ਼ਾ ਦੀ ਵਰਤੋਂ ਆਰਥਿਕ ਹਾਲਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਵਪਾਰ ਵਿੱਚ ਇੱਕ ਮੁੱਖ ਭਾਸ਼ਾ ਹੈ ਵਿਸ਼ੇਸ਼ ਤੌਰ 'ਤੇ ਪੰਜਾਬ ਵਿੱਚ ਲੋਕ ਆਪਣੇ ਧਾਰਮਿਕ ਸੰਸਾਰਕ ਅਤੇ ਵਪਾਰੀ ਸੰਗ੍ਰਹਿ ਦੀ ਖੋਜ ਵਿੱਚ ਪੰਜਾਬੀ ਭਾਸ਼ਾ ਨੂੰ ਵਧੀਆ ਸਮਝਦੇ ਹਨ ਅਸੀਂ ਦੇਖ ਸਕਦੇ ਹਾਂ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਨਾਲ ਵਪਾਰਿਕ ਵਿੱਚ ਆਪਣੀਆਂ ਦੁਕਾਨਾਂ ਵਪਾਰੀ ਮੀਟਿੰਗਾਂ ਅਤੇ ਸਿੱਖ ਪੇਸ਼ਕਸ਼ਾਂ ਵਿੱਚ ਸੁਵਿਧਾ ਹੋ ਜਾਂਦੀ ਹੈ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਦੀ ਉਹ ਪਛਾਣ ਹੈ ਕਿ ਸਰਕਾਰੀ ਕਾਰਿਆ ਕਰਮ ਅਨੁਸਾਰ ਅਤੇ ਨੀ ਨੀਤੀਆਂ ਨੂੰ ਪੰਜਾਬੀ ਵਿੱਚ ਪੇਸ਼ ਕੀਤਾ ਜਾਂਦਾ ਹੈ ਜੋ ਕਿ ਲੋਕਾਂ ਨੂੰ ਆਪਣੇ ਹੱਕ ਅਤੇ ਪੰਜਾਬੀ ਭਾਸ਼ਾ ਦੀ ਗੱਲਾਂ ਵਿੱਚ ਮਦਦ ਕਰਦਾ ਹੈ ਪੰਜਾਬੀ ਭਾਸ਼ਾ ਦੀ ਉਪਯੋਗਤਾ ਵਪਾਰਿਕ ਸੂਚਨਾ ਦੀ ਵਰਤੋਂ ਵਿੱਚ ਬਹੁਤ ਮਹੱਤਵਪੂਰਨ ਹੁੰਦੀ ਹੈ ਵਪਾਰਿਕ ਸਮਝ ਕਰ ਸਕਦੇ ਹਨ ਕਿ ਉਹਨਾਂ ਦੀ ਪਛਾਣ ਕਰਨ ਅਤੇ ਵਪਾਰੀ ਪੱਤਰਕਾਰਤਾ ਜਿਵੇਂ ਕਿ ਰਚਨਾਤਮਕ ਪੱਤਰ ਅਖਬਾਰ ਰੇਡੀਓ ਅਤੇ ਟੀ ਵੀ ਪ੍ਰੋਗਰਾਮਾਂ ਵਿੱਚ ਪੰਜਾਬੀ ਭਾਸ਼ਾ ਦੀ ਮੁੱਖ ਭਾਸ਼ਾ ਹੁੰਦਾ ਹੈ ਇਸ ਤਰ੍ਹਾਂ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਸਮਝਣਾ ਕਿ ਹਾਲਤ ਅਤੇ ਵਣਜਾਰਿਆਂ ਦੀ ਮਦਦ ਕਰਨ ਲਈ ਬਹੁਤ ਮਹੱਤਵਪੂਰਨ ਹੈ